ਜਿਵੇਂ ਕਿ ਅਸੀਂ ਜਾਣਦੇ ਹਾਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਸੀਂ ਬਹੁਤ ਜ਼ਿਆਦਾ ਸਿੱਖ ਬਹੁਤ ਕੁਝ ਸਿੱਖਦੇ ਹਾਂ ਅਤੇ ਕੁਝ ਚੀਜ਼ਾਂ ਅਸੀਂ ਨਵੀਆਂ ਸਿੱਖਦੇ ਹਾਂ ਮੈਨੂੰ ਇਹ ਲੱਗਦਾ ਹੈ ਕਿ ਅਗਰ ਜੇ ਅਸੀਂ ਹਰ ਦਿਨ ਇੱਕ ਨਵਾਂ ਸਿਖਾਂਗੇ ਤਾਂ ਅਸੀਂ ਹੋਰ ਵੀ ਜ਼ਿਆਦਾ ਤਾਂ ਅਸੀਂ ਹੋਰ ਹੋਰ ਵੀ ਜ਼ਿਆਦਾ ਨੋਲੇਜੇਬਲ ਹੋਵਾਂਗੇ ਇਸ ਦੇ ਨਾਲ ਹੀ ਮੇਰੀਆਂ ਸਭ ਤੋਂ ਵੱਡੀਆਂ ਸ਼ਕਤੀਆਂ ਮੇਰੇ ਆਪਣੇ ਮਾਂ ਬਾਪ ਹਨ ਕਿਉਂਕਿ ਮਾਤਾ ਪਿਤਾ ਉਹ ਬੂਟਾ ਹਨ ਜੋ ਹਰ ਵੇਲੇ ਖਿੜਿਆ ਰਹਿੰਦਾ ਹੈ ਅਤੇ ਮੇਰੀ ਹਰ ਜਗ੍ਹਾ ਮਦਦ ਕਰਦੇ ਹਨ ਅਤੇ ਮੈਨੂੰ ਦੁੱਖ ਹੋਣ 'ਤੇ ਉਹ ਹਮੇਸ਼ਾਂ ਮੇਰੇ ਨਾਲ ਖੜ੍ਹਦੇ ਹਨ ਦੂਜੇ ਪਾਸੇ ਮੇਰੀ ਇੱਕ ਵੱਡੀ ਕਮਜ਼ੋਰੀ ਇਹ ਹੈ ਕਿ ਮੈਂ ਹਰ ਇੱਕ 'ਤੇ ਬਹੁਤ ਜ਼ਿਆਦਾ ਭਰੋਸਾ ਕਰ ਲੈਂਦੀ ਹਾਂ ਜਿਸ ਕਰਕੇ ਮੈਂ ਭਰੋਸੇ ਕਰਨ ਦੇ ਨਾਲ ਆਪਣੀ ਗੱਲ ਉਨ੍ਹਾਂ ਦੇ ਅੱਗੇ ਪ੍ਰਸਤੁਤ ਕਰਦੀ ਹਾਂ ਪਰ ਅਖੀਰ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਆਉਂਦੀ ਹੈ ਅਤੇ ਮੈਨੂੰ ਇੱਹ ਲੱਗਦਾ ਹੈ ਕਿ ਮੇਹ ਮੇਰੀ ਇਹ ਸਭ ਤੋਂ ਵੱਡੀ ਕਮਜ਼ੋਰੀ ਹੈ